ਸਰੋਤਾਂ ਦੀ ਘਾਟ ਦੇ ਤੁਹਾਡੇ ਖੇਤਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਉਹਨਾਂ ਨੇ ਸਾਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਸਰੋਤਾਂ ਦੀ ਘਾਟ ਨੇ ਸਾਡੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਸਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਸਾਡਾ ਸਾਰਾ ਸਮਾਂ ਬਰਬਾਦ ਹੋ ਜਾਂਦਾ ਹੈ ਅਤੇ ਅਸੀਂ ਸਮੇਂ ਸਿਰ ਆਪਣੀ ਥਾਂ 'ਤੇ ਨਹੀਂ ਪਹੁੰਚ ਪਾਉਂਦੇ ਜੇਕਰ ਗੱਲ ਕਰੀਏ ਸਾਡੇ ਖੇਤਰ ਵਿੱਚ ਲੋੜੀਂਦੇ ਟੀਕਾਕਰਨ ਦੀ

ਉਹ ਸਾਡੇ ਇੱਥੇ ਪੂਰੀ ਤਰ੍ਹਾਂ ਉਪਲਬਧ ਨਹੀਂ ਹਨ ਸਾਨੂੰ ਇਹ ਇਹਨਾਂ ਦੇ ਪ ਤੱਕ ਪਹੁੰਚਣ ਲਈ ਕੋਈ ਵੀ ਸਰੋਤ ਨਹੀਂ ਹਨ ਜਿਸ ਕਾਰਨ ਮਰੀਜ਼ਾਂ ਦਾ ਸਮੇਂ ਟੀਕਾਕਰਨ ਨਹੀਂ ਹੋ ਸਕਦਾ ਜਿਹੜੇ ਟੀਕੇ ਬਿਮਾਰੀ ਚਾਹੀਦੇ ਉਹ ਨਾ ਹੋਣ ਕਾਰਨ ਸਾਨੂੰ ਪਿੰਡ ਤੋਂ ਬਾਹਰ ਜਾਣ ਲਈ ਕੋਈ ਸਾਧਨ ਨਾ ਹੋਣ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਇਸ ਲਈ ਮੈਂ ਸਰਕਾਰ ਅੱਗੇ ਅਪੀਲ ਕਰਦੀ ਹਾਂ ਕਿ ਸਾਨੂੰ ਟੀਕਾਕਰਨ ਕੇਂਦਰ ਜਾਣ ਲਈ ਚੰਗੇ ਸਰੋਤ ਦਿੱਤੇ ਜਾਣ ਜਿਸ ਨਾਲ ਅਸੀਂ ਆਪਣਾ ਟੀਕਾਕਰਨ ਸਮੇਂ ਸਿਰ ਕਰਵਾ ਸਕੀਏ ਅਤੇ ਆਪਣਾ ਇਲਾਜ ਕਰਵਾ ਸਕੀਏ